ਆਧੁਨਿਕਤਾ ਅਤੇ ਵਿਸ਼ਵੀਕਰਨ ਦੇ ਮੱਦੇ ਨਜ਼ਰ ਪੰਜਾਬ ਵਿੱਚ ਲੋਕ ਆਪਣੇ ਸੱਭਿਆਚਾਰਕ ਪਰੰਪਰਾਵਾਂ ਨੂੰ ਕਾਇਮ ਰੱਖਦੇ ਹਨ ਇਨ੍ਹਾਂ ਨੂੰ ਰੱਖਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਹਨ ਸਰਕਾਰ ਅਤੇ ਲੋਕ ਆਪਣੀ ਇੱਕਜੁਟਤਾ ਇੱਕਜੁਟਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਬਹੁਤ ਸਾਰੀਆਂ ਨੀਤੀਆਂ ਅਪਣਾਉਂਦੇ ਹਨ ਜਿਵੇਂ ਕਿ ਪੰਜਾਬ ਵਿੱਚ ਆਪਣੇ ਇਤਿਹਾਸ ਅਤੇ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਅਨੰਦਪੁਰ ਸਾਹਿਬ ਵਿੱਚ ਵਿਰਾਸਤ ਏ ਖਾਲਸਾ ਇੱਕ ਮਿਊਜ਼ੀਅਮ ਬਣਾਇਆ ਗਿਆ ਜਿਸ ਵਿੱਚ ਸਿੱਖ ਇਤਿਹਾਸ ਬਾਰੇ ਬਹੁਤ ਜਾਣਕਾਰੀ ਦਿੱਤੀ ਗਈ ਉਨ੍ਹਾਂ ਨੇ ਉਸ ਵਿੱਚ ਆਡੀਉ ਅਤੇ ਵੀਡੀਉ ਵਰਜ਼ਨ ਅਪਡੇਟਿਡ ਵਰਜ਼ਨ ਵੀ ਐਡ ਕੀਤੇ ਜਿਸ ਦੇ ਨਾਲ ਲੋਕ ਆਪਣੇ ਇੰਟਰਸਟ ਦੇ ਨਾਲ ਇਤਿਹਾਸ ਨੂੰ ਜਾਣ ਸਕਣ ਇਹ ਇੱਕ ਚੰਗਾ ਜ਼ਰੀਆ ਹੈ ਲੋਕਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਅਤੇ ਇਤਿਹਾਸ ਦੇ ਨਾਲ ਜੋੜਨ ਦਾ ਆਧੁਨਿਕਤਾ ਅਤੇ ਵਿਸ਼ਵੀਕਰਨ ਦੇ ਮੱਦੇ ਨਜ਼ਰ ਪੰਜਾਬ ਵਿੱਚ ਹੋਰ ਪਰੰਪਰਾਵਾਂ ਜਿਵੇਂ ਕਿ ਚਮਕੌਰ ਸਾਹਿਬ ਵਿੱਚ ਦਾਸਤਾਨ ਏ ਸ਼ਹਾਦਤ ਮਿਊਜ਼ੀਅਮ ਬਣਾਇਆ ਗਿਆ ਹੈ ਉਸ ਵਿੱਚ ਵੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਤਿਉਹਾਰ ਵੀ ਇਸ ਦਾ ਇੱਕ ਬਹੁਤ ਵੱਡਾ ਜ਼ਰੀਆ ਹੈ ਜਿਸ ਰਾਹੀਂ ਲੋਕ ਆਪਣੇ ਸੱਭਿਆਚਾਰ ਅਤੇ ਸੱਭਿਆਚਾਰ ਅਤੇ ਪਹਿਰਾਵੇ ਨੂੰ ਫੋਲੋ ਕਰਦੇ ਹਨ ਅਤੇ ਉਹ ਉਹ ਹੀ ਪਹਿਰਾਵਾ ਅਤੇ ਭੋਜਨ ਪਾਉਂਦੇ ਹਨ ਗਰੀਬੀ ਰੇਖਾ ਤੋਂ ਨੀਚੇ ਵੱਸਦੇ ਲੋਕ ਲੋਕ ਉਨ੍ਹਾਂ ਕੋਲ ਪੈਸੇ ਦੀ ਕਮੀ ਹੋਣ ਦੇ ਕਾਰਨ ਉਹ ਆਧੁਨਿਕਤਾ ਅਤੇ ਵਿਸ਼ਵੀਕਰਨ ਦੇ ਨਾਲ ਨਹੀਂ ਚੱਲ ਸਕਦੇ ਇਸ ਲਈ ਉਹ ਆਪਣੇ ਸੱਭਿਆਚਾਰ ਸੱਭਿਆਚਾਰ ਦੇ ਨਾਲ ਰਹਿੰਦੇ ਹੋਏ ਹੀ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ